ਹੁਣ ਪੰਜਾਬ ਵਿੱਚ ਗੁਰਦਾਸਪੁਰ ਇਲਾਕੇ ਦੇ ਲਾਗੇ ਇੱਕ ਨਵੀਂ ਵਾਈਲਡ ਲਾਈਫ ਸੈਂਚਰੀ ਬਣਾਈ ਗਈ ਹਨ ਜਿਸ 'ਤੇ ਹਰ ਮਹੀਨੇ ਨਵੇਂ ਨਵੇਂ ਜਾਨਵਰਾਂ ਨੂੰ ਲਿਆਇਆ ਜਾ ਰਿਹਾ ਹੈ ਵਾਈਲਡ ਲਾਈਫ ਸੈਂਚਰੀ ਤਾਂ ਇੰਨੀ ਜ਼ਿਆਦਾ ਮਸ਼ਹੂਰ ਹੋ ਰਹੀ ਹੈ ਕਿ ਉਸ ਨੇ ਭਾਰਤ ਵਿੱਚ ਰਿਕਾਰਡ ਹੀ ਤੋੜ ਦਿੱਤੇ ਹਨ ਸੱਤ ਡਾਰ ਟੂਰਿਜ਼ਮ ਵਾਸਤੇ ਲੋਕ ਤਾਂ ਵਾਈਲਡ ਲਾਈਫ ਸੈਂਚਰੀ ਵਿੱਚ ਇੰਨੇ ਜਾਨਵਰਾਂ ਨੂੰ ਦੇਖਣ ਆ ਰਹੇ ਹਨ ਕਿ ਲੋਕ ਸੋਚ ਰਹੇ ਹਨ ਕਿ ਕਦੋਂ ਕਦੋਂ ਬਾਕੀ ਜਾਨਵਰਾਂ ਨੂੰ ਵੀ ਦੇਖ ਸਕੀਏ ਅਤੇ ਕਦੋਂ ਕਦੋਂ ਨਵੇਂ ਜਾਨਵਰਾਂ ਨੂੰ ਲਿਆਇਆ ਜਾ ਰਿਹਾ ਵਾਈਲਡ ਲਾਈਫ ਸੈਂਚਰੀ ਦੇ ਮੈਨੇਜਰ ਤਾਂ ਜਾਨਵਰਾਂ ਨੂੰ ਬਾਹਰੋਂ ਵੀ ਬੁਲਾਏ ਬੁਲਾ ਰਹੇ ਹਨ ਮੰਗਵਾ ਰਹੇ ਹਨ ਤਾਂ ਕਿ ਹਰ ਇੱਕ ਲੋਕਾਂ ਵਾਸਤੇ ਨਵੀਂ ਨਵੀਂ ਪ੍ਰਜਾਤੀਆਂ ਦੇਖਣ ਵਾਸਤੇ ਹੋਈਏ ਉਸ 'ਤੇ ਲੋਕ ਤਾਂ ਇੰਨੇ ਪਾਗਲ ਹੋ ਚੁੱਕੇ ਹਨ ਕਿ ਉਹ ਤਾਂ ਹਜ਼ਾਰ ਹਜ਼ਾਰ ਦੋ ਹਜ਼ਾਰ ਜਾਂ ਹੋਰ ਵੀ ਬੜੇ ਪੈਸੇ ਦੇ ਕੇ ਹਰ ਇੱਕ ਜਾਨਵਰ ਨੂੰ ਦੇਖਣਾ ਚਾਹੁੰਦੇ ਹਨ ਉਸੇ 'ਤੇ ਨਵੀਂ ਨਵੀਂ ਸੁਵਿਧਾਵਾਂ ਵੀ ਖੁੱਲ੍ਹ ਰਹੀ ਹਨ ਜਿੱਦਾਂ ਗੱਡੀ ਵਿੱਚ ਸਫ਼ਰ ਕਰਨਾ ਮੋਟਰਸਾਈਕਲ 'ਤੇ ਸਫ਼ਰ ਕਰਨਾ ਜਾਂ ਫਿਰ ਪੈਦਲ ਸਫ਼ਰ ਕਰਨਾ ਅਜੇ ਤਾਂ ਉਹ ਨਵਾਂ ਹੀ ਬਣਾ ਹੈ ਜਿਹਦੇ ਕਾਰਨ ਹਜੇ ਹੋਰ ਵੀ ਸੁਵਿਧਾਵਾਂ ਨਹੀਂ ਹੈਗੀਆਂ ਪਰ ਉਹਨਾਂ ਨੇ ਵਾਅਦਾ ਕੀਤਾ ਹਨ ਕਿ ਜਿੱਦਾਂ ਜਿੱਦਾਂ ਇਸ ਦੀ ਤਰੱਕੀ ਹੋਊਗੀ ਆਪਾਂ ਹੋਰ ਹੋਰ ਸੈਂਚਰੀਆਂ ਨੂੰ ਉੱਥੇ ਬਣਾਵਾਂਗੇ ਅਤੇ ਹੋਰ ਉੱ ਸੁਵਿਧਾਵਾਂ ਨੂੰ ਉੱਥੇ ਪਰਾ ਪ੍ਰਾਪਤ ਕਰਾਂਗੇ